ਹਾਂਜੀ ਸਤਿ ਸ਼੍ਰੀ ਕਾਲ ਮੈਡਮ ਜੀ ਹਾਂਜੀ ਠੀਕ ਏ ਮੈਮ ਤੁਸੀਂ ਸੁਣਾਓ ਕਿੱਦਾਂ ਠੀਕ ਠਾਕ ਬਸ ਠੀਕ ਏ ਹੀ ਆ ਮੈਮ ਤੁਹਾਡੇ ਵੱਲ ਕਿੱਦਾਂ ਸਾਡੇ ਵੱਲ ਤਾਂ ਘੱਟੇ ਏ ਹੀ ਆ ਸਰ ਐਡਮਿਸ਼ਨਾ ਤੁਸੀਂ ਦੱਸੋ ਕਿੱਦਾਂ ਤੁਹਾਡੇ ਵੱਲ ਕੀ ਆ ਅੱਛਾ

ਹਾਂਜੀ ਮੈਮ ਸਾਡੇ ਵੱਲੋਂ ਤਾਂ ਬਹੁਤ ਘੱਟ ਆ ਐਡਮਿਸ਼ਨ ਮੈਮ ਬੱਚੇ ਜਿਦਾਂ ਇਧਰ ਨੂੰ ਘੱਟ ਆ ਰਹੇ ਆ ਫਾਮੈਸੀ ਵੱਲ ਨੂੰ ਤਾਂ ਕਰਕੇ ਵੀ ਐਡਮਿਸ਼ਨ ਵੀ ਘੱਟ ਏ ਹੀ ਆ ਇਸ ਵਾਰ ਹਾਂਜੀ ਇਹ ਤਾਂ ਹੈ ਹਾਂਜੀ ਹਾਂਜੀ ਫਾਮੈਸੀ 'ਚ ਹੈ ਨਹੀਂ ਹੈ ਇਸ ਵਾਰ ਐਡਮਿਸ਼ਨ ਜਿਦਾਂ ਹੁਣ ਤੁਹਾਡੇ ਵੱਲੋਂ ਤਾਂ ਹੈਗਾ ਥੋੜ੍ਹਾ ਜਿਹਾ ਚੱਲ ਰਹੀਆਂ ਐਡਮਿਸ਼ਨਸ ਹੈ ਨਾ

ਹਾਂਜੀ ਹਾਂਜੀ ਉਹੀ ਇਸੇ ਕਰਕੇ ਨਾ ਸਾਡੇ ਵੱਲ ਐਡਮਿਸ਼ਨਸ ਘੱਟ ਆ ਕੋਈ ਬੱਚੇ ਇਧਰ ਨੂੰ ਆਉਂਦੇ ਏ ਨਹੀਂ ਹੈਗੇ ਫਾਰਮੈਸੀ ਵੱਲ ਨੂੰ ਹੈ ਨਾ ਘੱਟ ਵਾ ਐਡਮਿਸ਼ਨ ਹੋਰ ਹਾਂਜੀ ਹਾਂਜੀ ਵਧੀਆ ਚੱਲ ਰਿਹਾ ਐਡਮਿਸ਼ਨਜ਼ ਸਾਰੀਆਂ ਵਧੀਆ ਚੱਲ ਰਹੀ ਐਡਮਿਸ਼ਨ ਵੀ ਕੰਮ ਕਾਰ ਵੀ ਵਧੀਆ ਚੱਲ ਰਿਹਾ ਚਲੋ ਠੀਕ ਹੈ